ਸਾਡੀ ਸਾਡੇ ਪਿੰਡ ਵਿੱਚ ਅੰਬਾਂ ਦੀ ਅੰਬਾਂ ਦੇ ਬਾਗ਼ ਹਨ ਜਿਸ ਵਿੱਚ ਤਿੰਨ ਤਰ੍ਹਾਂ ਦੇ ਅਸੀਂ ਅੰਬ ਲਗਾਏ ਹਨ ਕਲਮੀ ਅੰਬ ਸੰਦੂਰੀ ਅੰਬ ਅਤੇ ਦੇਸੀ ਅੰਬ ਅਤੇ ਇਹ ਚਾਰ ਕਿੱਲ੍ਹਿਆਂ ਵਿੱਚ ਫੈਲੀ ਹੋਈ ਹੈ ਅਤੇ ਇਹ ਸ਼ੁਰੂ ਤੋਂ ਹੀ ਅਸੀਂ ਕਰਦੇ ਹਨ ਪਹਿਲਾਂ ਮੇਰੇ ਦਾਦਾ ਜੀ ਕਰਦੇ ਹੁੰਦੇ ਸੀ ਫਿਰ ਮੇਰੇ ਪਿਤਾ ਜੀ ਕਰਦੇ ਸੀ ਫਿਰ ਹੁਣ ਇਹ ਹੁਣ ਮੈਂ ਕਰਨ ਲੱਗ ਗਿਆ ਅਤੇ ਇਹ ਇਹ ਇਸਦਾ ਮੈਨੂੰ ਬਚਪਨ ਤੋਂ ਹੀ ਸ਼ੌਂਕ ਹੈ ਬਾਗ਼ਬਾਨੀ ਦਾ ਅਤੇ ਇੱਥੇ ਮੈਂ ਆਪਣੇ ਬਾਗ਼ ਵਿੱਚ ਖ਼ੁਦ ਮੈਂ ਲਗਭਗ ਸੱਠ ਤੋਂ ਸੱਤਰ ਸੱਠ ਤੋਂ ਸੱਤਰ ਅੰਬਾਂ ਦੇ ਬੂਟੇ ਲਗਾਏ ਹਨ ਅਤੇ ਮੈਂ ਘਰ ਵੀ ਛੋਟੀ ਜਿਹੀ ਬਾਗ਼ਬਾਨੀ ਤਿਆਰ ਕੀਤੀ ਹੋਈ ਹੈ ਜਿਸ ਵਿੱਚ ਚਾਰ ਤਰ੍ਹਾਂ ਦੇ ਫੁੱਲ ਹਨ ਇੱਕ ਰੈੱਡ ਰੋਜ਼ ਹੋ ਗਿਆ ਜੀ ਲਾਲ ਗੁਲਾਬ ਅਤੇ ਆਪਣਾ ਜੈਸਮੀਨ ਗੁਲਾਬ ਹੋ ਗਿਆ ਜੀ ਗੈਂਦੇ ਦੇ ਫੁੱਲ ਹੋ ਗਏ ਜੀ ਅਤੇ ਹੋਰ ਇੱਕ ਕਈ ਤਰ੍ਹਾਂ ਦੇ ਫੁੱਲ ਲਗਾਏ ਹਨ ਅਤੇ ਅਸੀਂ ਆਪਣੇ ਮੱਝਾਂ ਵਾਲੇ ਬਾੜੇ ਦੇ ਵਿੱਚ ਜਿੱਥੇ ਜਗ੍ਹਾ ਖਾਲੀ ਪਈ ਸੀ ਉੱਥੇ ਅਸੀਂ ਉੱਥੇ ਅਸੀਂ ਆਪਣਾ ਅਸ਼ੋਕ ਟਰੀ ਵਗੈਰਾ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਸਿਨਰੀ ਟਾਈਪ ਬਣਾਇਆ ਹੋਇਆ ਹੈ ਜੀ ਅਤੇ ਇਸ ਵਿੱਚ ਕਰਨ ਦਾ ਮੇਰਾ ਮੁੱਖ ਕਾਰਨ ਇਹ ਹੈ ਅਤੇ ਇੱਕ ਤਾਂ ਇਹ ਕੁਦਰਤ ਨੂੰ ਵਧੀਆ ਰੱਖਦੀ ਹੈ ਜੀ ਅਤੇ ਉੱਤੋਂ ਇਸ ਵਿੱਚ ਜਿਵੇਂ ਹੁਣ ਸਾਡੇ ਅੰਬਾਂ ਦੇ ਬਾਗ਼ ਹੈ ਇੰਨੇ ਉਹ ਉਸ ਵਿੱਚੋਂ ਕਮਾਈ ਵੀ ਹੋ ਰਹੀ ਹੈ ਕੁਦਰਤ ਦਾ ਉਹ ਵੀ ਹੈ ਜੀ ਵਧੀਆ ਰੱਖਦੀ ਹੈ ਇਹ ਆਪਣਾ ਪੋਲਊਸ਼ਨ ਘੱਟ ਹੁੰਦਾ ਹੈ ਔਕਸੀਜਨ ਦੀ ਮਾਤਰਾ ਵੱਧਦੀ ਹੈ ਜੀ ਅਤੇ ਇਸ ਨਾਲ਼ ਸਾਡੇ ਪਿੰਡ ਦੇ ਦੋ ਤਿੰਨ ਬੰਦਿਆਂ ਨੂੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ ਜੀ ਅਤੇ ਇਹ ਇੱਕ ਬਹੁਤ ਹੀ ਵੱਡਾ ਜਿਵੇਂ ਮੌਸਮ ਅੰਬਾਂ ਦਾ ਮੌਸਮ ਹੁੰਦਾ ਹੈ ਅਤੇ ਉਹਨਾਂ 'ਚ ਸਾਨੂੰ ਬਹੁਤ ਹੀ ਵੱਡਾ ਲਾਭ ਵੀ ਹੁੰਦਾ ਹੈ ਜੀ ਕਮਾਈ ਦਾ ਸੌਰਸ ਅਤੇ ਇਹ ਬਾਗ਼ਬਾਨੀ ਤਾਂ ਸ਼ੁਰੂ ਤੋਂ ਹੀ ਸਾਡਾ ਬਹੁਤ ਹੀ ਜ਼ਿਆਦਾ ਰੁਝੇਵਾਂ ਰਿਹਾ ਹੈ ਪੁਸ਼ਤਾਂ ਤੋਂ